ਇੱਕ ਵਾਰੀ ਚਿੱਤਰਕਾਰੀ ਕਰਦੇ ਹੋਏ ਮੈਂ ਮਾਂ ਸ਼ਬਦ ਬਣਾਇਆ ਹੁਣ ਸਭ ਨੂੰ ਪਤਾ ਹੈ ਕਿ ਮਾਂ ਸ਼ਬਦ ਦਾ ਅਰਥ ਬਹੁਤ ਹੀ ਡੂੰਘਾ ਅਤੇ ਮਹੱਤਵਪੂਰਨ ਹੈ ਮਾਂ ਤੋਂ ਬਿਨਾਂ ਸ੍ਰਿਸ਼ਟੀ ਦਾ ਸੰਚਾਰ ਨਹੀਂ ਹੋ ਸਕਦਾ ਸੀ ਮਾਂ ਹੀ ਇਸ ਸੰਸਾਰ ਦੀ ਕਰਤਾ ਧਰਤਾ ਹੈ ਮਾਂ ਤੋਂ ਵੱਧ ਕੇ ਕੋਈ ਵੀ ਨਹੀਂ ਇੱਕ ਮਾਂ ਹੀ ਹੈ ਜਿਸਨੂੰ ਘੜੀ ਦੋ ਘੜੀ ਕੁਝ ਫੜਾ ਦਿੱਤਾ ਜਾਵੇ ਮੰਨ ਲਓ ਕਿਸੇ ਔਰਤ ਨੂੰ ਤਾਂ ਉਸ ਨੂੰ ਉਸ ਦਾ ਭਾਰ ਦੋ ਤਿੰਨ ਘੰਟੇ ਬਾਅਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਮਾਂ ਮਾਂ ਇੱਕ ਐਸੀ ਹੈ ਜੋ ਨੌਂ ਮਹੀਨੇ ਤੱਕ ਆਪਣੇ ਧੀ ਜਾਂ ਪੁੱਤਰ ਨੂੰ ਆਪਣੀ ਕੁੱਖ ਵਿੱਚ ਚੁੱਕ ਕੇ ਰੱਖਦੀ ਹੈ ਅਤੇ ਉਸ ਨੂੰ ਉਸਦਾ ਭਾਰ ਮਹਿਸੂਸ ਨਹੀਂ ਹੁੰਦਾ ਸਭ ਨੂੰ ਮਾਂ ਸ਼ਬਦ ਦੀ ਅਤੇ ਮਾਂ ਦੀ ਮਹੱਤਤਾ ਪਤਾ ਹੈ ਇਸ ਸ਼ਬਦ ਦੀ ਜਾਂ ਮਾਂ ਦੀ ਮਹੱਤਤਾ ਦੱਸ ਕੇ ਬਿਆਨ ਕੀਤੀ ਨਹੀਂ ਜਾ ਸਕਦੀ ਕਿਉਂਕਿ ਮਾਂ ਦੇ ਚਰਨਾਂ ਵਿੱਚ ਮਾਂ ਦੇ ਪੈਰਾਂ ਵਿੱਚ ਹੀ ਸਵਰਗ ਬੈਕੁੰਠ ਸਾਰੇ ਤੀਰਥ ਹਨ ਇਸਦੀ ਮਹਾਨਤਾ ਇਸ ਦੀ ਮਹੱਤਤਾ ਸ਼ਬਦਾਂ 'ਚ ਜਾਂ ਕਿਸੇ ਵੀ ਤਰੀਕੇ ਨਾਲ ਬਿਆਨ ਕਰਨ ਤੋਂ ਵੀ ਅੰਤ ਤੋਂ ਵੀ ਅੰਤ ਤੋਂ ਵੀ ਅੰਤ ਤੋਂ ਵੀ ਅੱਗੇ ਹੈ ਇਸ ਲਈ ਮੈਂ ਇਸ ਦੀ ਡੂੰਘਾਈ ਜਾਂ ਫਿਰ ਮਹੱਤਤਾ ਸ਼ਬਦਾਂ 'ਚ ਬਿਆਨ ਕਰਨ 'ਚ ਅਸਮਰਥ ਹਾਂ